ਅਸਲ ਵਿੱਚ ਮੈਂ ਤੁਹਾਨੂੰ ਆਪਣਾ ਸਵਿੱਗੀ ਦੇ ਉੱਤੇ ਜੋ ਔਡਰ ਕੀਤਾ ਸੀ ਇੱਕ ਕਿੱਲੋ ਮੈਂ ਜਲੇਬੀਆਂ ਮੰਗਵਾਈਆਂ ਸੀ ਤੁਹਾਡੀ ਦੁਕਾਨ ਦੇ ਉੱਤੇ ਅਤੇ ਉਹਦੇ ਵਿੱਚ ਮੈਂ ਜਦੋਂ ਔਡਰ ਪਹਿਲਾਂ ਤਾਂ ਤੁਹਾਡੀ ਦੁਕਾਨ ਵਾਲੇ ਨੇ ਔਡਰ ਲੈ ਲਿਆ ਅਤੇ ਮੈਂ ਅੱਧਾ ਘੰਟਾ ਵੇਟ ਕੀਤਾ ਅੱਧਾ ਘੰਟਾ ਵੇਟ ਕਰਨ ਤੋਂ ਬਾਅਦ ਜਦੋਂ ਮੈਨੂੰ ਔਡਰ ਨਹੀਂ ਮਿਲਿਆ ਮੇਰੇ ਘਰ ਮਹਿਮਾਨ ਆਏ ਹੋਏ ਸੀ ਅਤੇ ਮੈਂ ਉਹਨਾਂ ਦੇ ਲਈ ਔਡਰ ਕੀਤਾ ਸੀ ਤਾਂ ਜੋ ਉਹਨਾਂ ਨੂੰ ਚਾਹ ਦੇ ਨਾਲ ਦੇ ਸਕਾਂ ਅਤੇ ਪਰ ਜਦੋਂ ਮੈਂ ਅੱਧਾ ਘੰਟਾ ਵੇਟ ਕਰਨ ਤੋਂ ਬਾਅਦ ਤੁਹਾਡੀ ਦੁਕਾਨ ਵਾਪਸ ਸਵਿੱਗੀ ਨੂੰ ਕੋਲ ਕੀਤੀ ਤਾਂ ਉਹ ਕਹਿੰਦੇ ਸਾਨੂੰ ਔਡਰ ਮਿਲਿਆ ਹੀ ਨਹੀਂ ਅਤੇ ਜਿਹੜਾ ਔਡਰ ਦਿੱਤਾ ਜਦੋਂ ਮੈਂ ਉਹਨਾਂ ਨੂੰ ਵਾਪਸ ਕੋਲ ਕਰਕੇ ਉਹ ਕਹਿੰਦੇ ਜੀ ਅਸੀਂ ਹੁਣੇ ਬੈਕ ਚੈੱਕ ਕਰਦੇ ਹਾਂ ਅਤੇ ਬੈਕ ਚੈੱਕ ਕਰਨ ਤੋਂ ਬਾਅਦ ਉਹਨਾਂ ਨੇ ਜੀ ਕਿਹਾ ਵੀ ਹਾਂ ਮੈਨੂੰ ਵਾਪਸ ਕੋਲ ਆਈ ਕਹਿੰਦੇ ਵੀ ਅਸੀਂ ਤੁਹਾਡਾ ਡਿਲ ਸਾਨੂੰ ਰੈਸਟੋਰੈਂਟ ਵੱਲੋਂ ਹੀ ਜਿਹੜਾ ਔਡਰ ਸੀ ਉਹ ਅੱਗੇ ਫਰਦਰ ਕਨਵੇ ਨਹੀਂ ਕੀਤਾ ਗਿਆ ਕੋਈ ਗੱਲ ਨਹੀਂ ਹੁਣ ਸਾਨੂੰ ਰਿਪੋਰਟਿੰਗ ਹੋ ਗਈ ਅਸੀਂ ਤੁਹਾਡਾ ਔਡਰ ਪਹੁੰਚਾਉਂਦੇ ਹਾਂ ਅਤੇ ਮੇਰੀ ਐਨੀ ਕਾਰਵਾਈ ਤੋਂ ਬਾਅਦ ਉਹਨਾਂ ਨੇ ਜੀ ਵਾਪਸ ਸਵਿੱਗੀ ਬੋਆਏ ਜਿਹੜਾ ਸੀ ਤੁਹਾਡੀ ਦੁਕਾਨ 'ਤੇ ਪਹੁੰਚਿਆ ਅਤੇ ਦੁਕਾਨ ਤੋਂ ਜਿਹੜਾ ਸੀਗਾ ਵੀ ਤੁਸੀਂ ਇੱਕ ਕਿੱਲੋ ਜਲੇਬੀਆਂ ਮੰਗਵਾਈਆਂ ਸੀ ਮੈਂ ਪਰ ਉਹ ਜਲੇਬੀਆਂ ਦੀ ਥਾਂ 'ਤੇ ਮੈਨੂੰ ਕੀ ਮਿਲਿਆ ਸਿਰਫ ਅੱਧਾ ਕਿੱਲੋ ਜਲੇਬੀਆਂ ਮਿਲੀਆਂ ਅਤੇ ਜਦੋਂ ਉਹ ਪੌਣੇ ਘੰਟੇ ਬਾਅਦ ਮੈਨੂੰ ਡਿਲੀਵਰ ਹੋਇਆ ਮੇਰੇ ਮਹਿਮਾਨਾਂ ਦੀ ਚਾਹ ਵੀ ਠੰਡੀ ਹੋ ਚੁੱਕੀ ਸੀ ਮੈਂ ਉਹਨਾਂ ਨੂੰ ਹਰ ਹੋਰ ਕਾਸੇ ਦੇ ਨਾਲ ਸਰਵ ਕੀਤਾ ਅਤੇ ਜਦੋਂ ਉਹਨੂੰ ਮੈਨੂੰ ਔਡਰ ਜਦੋਂ ਮੈਂ ਚੈੱਕ ਕੀਤਾ ਪਹਿਲਾਂ ਤਾਂ ਉਹ ਠੰਡੀਆਂ ਸੀਗੀਆਂ ਉਸ ਤੋਂ ਬਾਅਦ ਜੀ ਉਹ ਹੈ ਵੀ ਵੇਟ ਦੇ ਵਿੱਚ ਅੱਧਾ ਕਿੱਲੋ ਸੀ ਅਤੇ ਮੈਂ ਦੁਬਾਰਾ ਫੇਰ ਤੁਹਾਨੂੰ ਤੁਹਾਡੇ ਕੋਲ ਕੀਤੀ ਦੁਕਾਨ ਦੇ ਉੱਤੇ ਸਵੀਟ ਸ਼ੌਪ ਦੇ ਉੱਤੇ ਅਤੇ ਰੈਸਟੋਰੈਂਟ ਵਾਲੇ ਕਹਿੰਦੇ ਜੀ ਸਾਡਾ ਰੈਸਟੋਰੈਂਟ ਬਹੁਤ ਫੁੱਲ ਚੱਲ ਰਿਹਾ ਸੀ ਇਸ ਕਰਕੇ ਅਸੀਂ ਸਵੀਟਸ ਦੀ ਡਿਲੀਵਰੀ ਹੈ ਜਿਹੜੀ ਉਹ ਤੁਹਾਡੀ ਪ੍ਰੋਪਰਲੀ ਸਾਡੇ ਬੰਦੇ ਨੇ ਹੈਂਡਲ ਨਹੀਂ ਕੀਤੀ ਹੈਗੀ ਅਤੇ ਪਰ ਉਹਦਾ ਨੁਕਸਾਨ ਕੀ ਹੋਇਆ ਵੀ ਮੈਨੂੰ ਇੱਕ ਕਿੱਲੋ ਦੀ ਨਾਲੇ ਤਾਂ ਮੈਂ ਪੇਮੈਂਟ ਕੀਤੀ ਆ ਪਲੱਸ ਜਿਹੜੇ ਮੇਰੇ ਮਹਿਮਾਨ ਨੇ ਉਹ ਜਿਹੜੇ ਨੇ ਖੱਜਲ ਹੋਏ ਮੈਂ ਉਹਨਾਂ ਨੂੰ ਪ੍ਰੋਪਰ ਜਿਹੋ ਜਿਹੀ ਸਰਵਿਸ ਦੇਣੀ ਸੀਗੀ ਜਿੰਨਾ ਉਹਨਾਂ ਦਾ ਸਵਾਗਤ ਕਰਨਾ ਸੀ ਉਹ ਨਹੀਂ ਕਰ ਪਾਈ ਪਲੱਸ ਜਿਹੜਾ ਮੇਰੀ ਹਰਾਸਮੈਂਟ ਹੋਈ ਮੈਂ ਉਹਨਾਂ ਨੂੰ ਅਟੈਂਡ ਕਰਨ ਦੀ ਬਜਾਏ ਜਿਹੜਾ ਤੁਹਾਡੇ ਇਹਦੇ 'ਚ ਹੀ ਲੱਗੀ ਰਹੀ ਉਹ ਤੋਂ ਬਾਅਦ ਮੈਨੂੰ ਜਿਹੜੀਆਂ ਜਲੇਬੀਆਂ ਸੀ ਉਹਨਾਂ ਦੀ ਕੁਆਲਿਟੀ ਵੀ ਬੜੀ ਪੂਅਰ ਸੀਗੀ ਪਲੱਸ ਮੈਂ ਹੁਣ ਕਿਸੇ ਨੂੰ ਰਿਕਮੈਂਡ ਕੀ ਕਰਾਂ ਤੁਹਾਡੀ ਸ਼ੌਪ ਜਦਕਿ ਮੈਨੂੰ ਬਹੁਤ ਮਤਲਬ ਕਿਸੇ ਨੇ ਕਿਹਾ ਸੀ ਵੀ ਤੁਹਾਡੀ ਗੁਰੂ ਨਾਨਕ ਜਿਹੜੇ ਸਵੀਟਸ ਹੈਗੀ ਆ ਬਹੁਤ ਵਧੀਆ ਸ਼ੌਪ ਹੈਗੀ ਆ ਅਤੇ ਇਸ ਕਰਕੇ ਮੈਂ ਤੁਹਾਡੀ ਦੁਕਾਨ 'ਤੇ ਔਡਰ ਕੀਤਾ ਸੀ ਪਰ ਮੈਂ ਤੁਹਾਡੀ ਜਿਹੜੀ ਇਹ ਡਿਲੀਵਰੀ ਸੀਗੀ ਪਹਿਲਾਂ ਤਾਂ ਔਡਰ ਗਲਤ ਜਿਹੜੇ ਨੇ ਲਿਖਿਆ ਉਹਨੇ ਨੋਟ ਨਹੀਂ ਕੀਤਾ ਵੀ ਮੈਂ ਇੱਕ ਕਿੱਲੋ ਕਹੀਆਂ ਕਿ ਅੱਧਾ ਕਿੱਲੋ ਕਹੀਆਂ ਉਸ ਤੋਂ ਬਾਅਦ ਜਿਹੜੀਆਂ ਪੁਰਾਣੀਆਂ ਬਚੀਆਂ ਹੋਈਆਂ ਠੰਡੀਆਂ ਜਲੇਬੀਆਂ ਸੀ ਮੈਨੂੰ ਉਹੀ ਜਿਹੜੀਆਂ ਡਿਲੀਵਰ ਕਰਤੀਆਂ ਮੈਂ ਇਹਦੇ ਤੋਂ ਕਾਫੀ ਪਰੇਸ਼ਾਨ ਹੋਈ ਹਾਂ ਪਲੀਜ਼ ਇਹਨੂੰ ਧਿਆਨ ਦਿਉ ਤਾਂ ਜੋ ਕਿਸੇ ਹੋਰ ਨੂੰ ਇਹ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ